ਪੰਦਰਾਂ ਨਵੰਬਰ ਉੱਨੀ ਸੌ ਵੀਹ ਬਾਰਾਂ ਜਨਵਰੀ ਦੋ ਹਜ਼ਾਰ ਸਤਾਰਾਂ ਦੋ ਦਸੰਬਰ ਦੋ ਹਜ਼ਾਰ ਦੋ ਛੱਬੀ ਮਾਰਚ ਉੱਨੀ ਸੌ ਸੈਂਤੀ ਅਠਾਰਾਂ ਅਗਸਤ ਦੋ ਹਜ਼ਾਰ ਤਿੰਨ